ਮੈਂ ਬਾਈ ਸਾਲ ਦਾ ਨੌਜਵਾਨ ਖਿਡਾਰੀ ਹਾਂ ਕੱਲ੍ਹ ਸਟੇਡੀਅਮ ਵਿੱਚ ਖੇਡਦੇ ਸਮੇਂ ਮੈਨੂੰ ਮੇਰੇ ਗਿੱਟੇ ਵਿੱਚ ਸੱਟ ਲੱਗ ਗਈ ਹੈ ਇਹ ਮੋਚ ਜਾਪਦੀ ਹੈ ਕਿਉਂਕਿ ਮੇਰਾ ਗਿੱਟਾ ਸੁੱਜ ਗਿਆ ਹੈ ਅਤੇ ਬਹੁਤ ਪੀੜ ਹੋ ਰਹੀ ਹੈ ਮੈਂ ਜਦੋਂ ਓਨਲਾਈਨ ਨਜ਼ਦੀਕੀ ਖੇਡ ਦਵਾਈ ਕਲੀਨਿਕ ਦੀ ਜਾਂਚ ਕੀਤੀ ਤਾਂ ਮੈਨੂੰ ਤੁਹਾਡੇ ਕਲੀਨਿਕ ਦਾ ਪਤਾ ਲੱਗਿਆ ਜੋ ਕਿ ਮੇਰੇ ਸਟੇਡੀਅਮ ਦੇ ਨੇੜੇ ਹੈ ਮੈਂ ਜਾਣਨਾ ਚਾਹੁੰਦਾ ਹਾਂ ਕਿ ਮੈਨੂੰ ਦਵਾਈ ਜਲਦ ਤੋਂ ਜਲਦ ਕਦੋਂ ਮਿਲ ਸਕਦੀ ਹੈ